ਹਾਂ ਸਾਡੇ ਇਲਾਕੇ ਦੇ ਸਕੂਲਾਂ ਵਿੱਚ ਇਤਿਹਾਸ ਪੜ੍ਹਾਇਆ ਜਾਂਦਾ ਹੈ ਪਰ ਇਹ ਬਿਆਨ ਕੀਤੇ ਗਏ ਇਤਿਹਾਸ ਨਾਲੋਂ ਵੱਖਰਾ ਇਤਿਹਾਸ ਹੈ ਕਿਉਂਕਿ ਅੱਜ ਕੱਲ੍ਹ ਜੋ ਕਿ ਹੈ ਇਤਿਹਾਸ ਹੈ ਹਰੇਕ ਰਾਈਟਰ ਦਾ ਅਲੱਗ ਅਲੱਗ ਇਤਿਹਾਸ ਬਾਰੇ ਲਿਖਿਆ ਹੋਇਆ ਹੈ ਹ ਹਰ ਰਾਈਟਰ ਆਪਣਾ ਜੋ ਹੈ ਆਪਣੇ ਅਕੋਰਡਿੰਗ ਹੀ ਇਤਿਹਾਸ ਨੂੰ ਲਿਖਦਾ ਹੈ ਆਪਣੀ ਨੋਲਜ ਅਕੋਰਡਿੰਗ ਸਭ ਕੁਛ ਬਿਆਨ ਕਰਦਾ ਹੈ ਕ ਕਿਸੇ ਤੁਸੀਂ ਕੋਈ ਵੀ ਕੁਛ ਵੀ ਕਿਤਾਬ ਚੱਕ ਲਓ ਕਿਸੇ ਕੋਈ ਇਤਿਹਾਸ ਬਾਰੇ ਕੋਈ ਜਾਣਕਾਰੀ ਕਿ ਕਿਸੇ ਬੁੱਕ ਵਿੱਚ ਕੁਝ ਅਲੱਗ ਹੁੰਦੇ ਅਤੇ ਕਿਤੇ ਕੁਝ ਅਲੱਗ ਦਿੱਤਾ ਗਿਆ ਹੁੰਦਾ ਹੈ ਅਤੇ ਇਹ ਬੱਚਿਆਂ ਤੱਕ ਜੋ ਹੈ ਅਲੱਗ ਅਲੱਗ ਤਰੀਕੇ ਨਾਲ ਪਹੁੰਚਾਇਆ ਜਾਂਦਾ ਹੈ ਅੱਧੀ ਕਿਸੇ ਕਿਸੇ ਜਗ੍ਹਾ 'ਤੇ ਅਧ ਅੱਧੀ ਅਧੂਰੀ ਨੌਲੇਜ ਦਿੱਤੀ ਗਈ ਹੁੰਦੀ ਹੈ ਕਿਤੇ ਪੂਰਾ ਦੱਸਿਆ ਗਿਆ ਹੁੰਦਾ ਹੈ ਅਤੇ ਆਮ ਭਾਰਤ ਵਿੱਚ ਕਈ ਇਤਿਹਾਸਿਕ ਘਟਨਾਵਾਂ ਹੋਈਆਂ ਨੇ ਜੋ ਕਿ ਮੇਰੇ ਖਿਆਲ ਦੇ ਇੱਕ ਵਿੱਚ ਜੋ ਕਿ ਬੱਚਿਆਂ ਨੂੰ ਪੜ੍ਹਾਉਣੀਆਂ ਚਾਹੀਦੀਆਂ ਹਨ ਅਤੇ ਤੁਸੀਂ ਇਹ ਵੀ ਕਹਿਣਾ ਚਾਹੁੰਦੀ ਹਾਂ ਕਿ ਬੱਚਿਆਂ ਨੂੰ ਜੋ ਕਿ ਹੈ ਪੁਰਾਣਾ ਸਿਰਫ ਗੁਰੂ ਪੀਰਾਂ ਜੋ ਕਿ ਮੁਗਲਾਂ ਬਾਰੇ ਹੀ ਪੜ੍ਹਾਇਆ ਜਾ ਰਿਹਾ ਹੈ ਅਤੇ ਇਹਨਾਂ ਤੋਂ ਇਲਾਵਾ ਮੈਂ ਚਾਹੁੰਦੀ ਹਾਂ ਕਿ ਬੱਚਿਆਂ ਨੂੰ ਜੋ ਹੈ ਕਿ ਆਪਣੇ ਭਾਰਤ ਦੇਸ਼ ਵਿੱਚ ਕੀ ਚੱਲ ਰਿਹਾ ਸੀ ਕੀ ਕੀ ਹੋਇਆ ਸੀ ਕਿਨ੍ਹਾਂ ਨੇ ਕੀ ਕੀ ਸਟਰਗਲ ਕੀਤੇ ਆਪਣੇ ਦੇਸ਼ ਨੂੰ ਆਜ਼ਾਦ ਕਰਨ ਲਈ ਕੀ ਕੀ ਸੀਗਾ ਕਿੱਥੇ ਸਾਨੂੰ ਕਿੱਥੇ ਗਰੀਬੀ ਦਾ ਸਾਹਮਣਾ ਕਰਨਾ ਪਿਆ ਕਿੱਥੇ ਕਿੱਥੇ ਕੀ ਕੀ ਹੋਇਆ ਇਸ ਨਾਲੋਂ ਲੋਕ ਬਹੁਤ ਹੀ ਜ਼ਿਆਦਾ ਵਾਂਝੇ ਨੇ ਕੁਝ ਨੋਲੇਜ ਹੁੰਦੀ ਹੈ ਕਿ ਬੱਚਿਆਂ ਨੂੰ ਸਿਰਫ ਆਪਣੇ ਏਰੀਏ ਅਕੋਰਡਿੰਗ ਹੀ ਆਪਣੇ ਇਤਿਹਾਸ ਦਾ ਪਤਾ ਹੁੰਦਾ ਹੈ ਅਤੇ ਮੈਂ ਚਾਹੁੰਦੀ ਹਾਂ ਕਿ ਬੱਚਿਆਂ ਨੂੰ ਜੋ ਕਿ ਸਕੂਲਾਂ ਵਿੱਚ ਸਾਰੇ ਏਰੀਆ ਦੇ ਇਤਿਹਾਸ ਦਾ ਇਤਿਹਾਸ ਦਾ ਪੜ੍ਹਾਇਆ ਜਾਣਾ ਚਾਹੀਦਾ ਹੈ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਭਾਰਤ ਵਿੱਚ ਪਿੱਛੇ ਹੀ ਨੋਟਬੰਦੀ ਹੋਈ ਸੀ ਕਿ ਜੋ ਕਿ ਇਤਿਹਾਸ ਵਿੱਚ ਦੂਜੀ ਵਾਰ ਹੋਈ ਹੈ ਅਤੇ ਬੱਚਿਆਂ ਨੂੰ ਇਹ ਪੜ੍ਹਾਇਆ ਜਾਣਾ ਚਾਹੀਦਾ ਕਿ ਸਕੂਲਾਂ ਵਿੱਚ ਕਿ ਨੋਟਬੰਦੀ ਦੀ ਸਾਨੂੰ ਲੋੜ ਕਿਉਂ ਪਈ ਇਸ ਦੀ ਕੀ ਜ਼ਰੂਰਤ ਸੀ ਕਿ ਸਾਨੂੰ ਨੋਟਬੰਦੀ ਕਰਨੀ ਪਈ ਅਤੇ ਇਸ ਤੋਂ ਬਾਅਦ ਸਾਡੀ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਭ ਭ ਭਾਰਤ ਵਿੱਚ ਜਿਵੇਂ ਕਿ ਮੋਦੀ ਸਰਕਾਰ ਨੇ ਤਿੰਨ ਸੌ ਸੱਤਰ ਧਾਰਾ ਹਟਾਈ ਅਤੇ ਇਸਦਾ ਮੁੱਖ ਕਾਰਨ ਕੀ ਸੀ ਇਹ ਕੁਝ ਜਾਣਕਾਰੀ ਤੋਂ ਜੋ ਹੈ ਕਿ ਕੁਝ ਬੱਚੇ ਵਾਂਝੇ ਨੇ ਜੋ ਕਿ ਜਿਨ੍ਹਾਂ ਨੂੰ ਨਹੀਂ ਪਤਾ ਉਹ ਗਲਤ ਨੌਲੇਜ ਇਕੱਠੀ ਕਰਦੇ ਨੇ ਉਹ ਦੁਨੀਆ ਉਹੀ ਆਤੰਕਵਾਦ ਫੈਲਾਉਂਦੇ ਨੇ ਅਤੇ ਮੈਂ ਚਾਹੁੰਦੀ ਹਾਂ ਜੇ ਉਹਨਾਂ ਨੂੰ ਇਸ ਦਾ ਪਤਾ ਹੋਏਗਾ ਤਾਂ ਉਹ ਦੇਸ਼ ਵਿੱਚ ਇੱਕ ਇਕੱਠੇ ਹੋ ਕੇ ਚੱਲਣਗੇ ਅਤੇ ਇਕੱਠੇ ਸਭ ਨਾਲ ਮੇਲ ਜੋਲ ਕਰਕੇ ਆਪਣੇ ਦੇਸ਼ ਨੂੰ ਵਧੀਆ ਬਣਾਉਣਗੇ ਉਹਨਾਂ ਨੂੰ ਆਪਣੇ ਇਤਿਹਾਸ ਦਾ ਪਤਾ ਹੋਣਾ ਚਾਹੀਦਾ ਕਿ ਅਸੀਂ ਕਿੱਥੋਂ ਸ਼ੁਰੂ ਹੋਏ ਹਾਂ ਅਤੇ ਸਾਡਾ ਕੀ ਦੇਸ਼ ਕਿੱਥੇ ਚੱਲ ਰਿਹਾ ਹੈਗਾ ਧੰਨਵਾਦ